ਸਤਿ ਸ਼੍ਰੀ ਅਕਾਲ ਮੈਂ ਐਮਜੋਨ ਤੋਂ ਪਰਸੋਂ ਇੱਕ ਔਡਰ ਮੰਗਵਾਇਆ ਸੀਗਾ ਉਹਦੇ ਨਾਲ ਮੈਨੂੰ ਇਹ ਕੂਪਨ ਪ੍ਰਾਪਤ ਹੋਇਆ ਸੀਗਾ ਉਸ ਕੂਪਨ ਦੀ ਵਰਤੋਂ ਮੈਨੂੰ ਨਹੀਂ ਕਰਨੀ ਆਉਂਦੀ ਇਸ ਕਰਕੇ ਮੈਨੂੰ ਉਸ ਕੂਪਨ ਦੀ ਵਰਤੋਂ ਬਾਰੇ ਦੱਸਿਆ ਜਾਵੇ ਜਿਸ ਕਰਕੇ ਮੈਂ ਆਪਣੇ ਅਗਲੇ ਔਡਰ ਜਾਂ ਜਦੋਂ ਵੀ ਮੈਂ ਆਪਣਾ ਅਗਲਾ ਔਡਰ ਮੰਗਾਵਾਂ ਉਸ 'ਤੇ ਮੈਂ ਉਸ ਕੂਪਨ ਦੀ ਵਰਤੋਂ ਨਾਲ ਉੱਤੇ ਛੂਟ ਪਾ ਸਕਾਂ